ਮੈਂ ਚਿੱਤਰਕਾਰੀ ਨੂੰ ਇੰਨਾ ਨਹੀਂ ਚਾਹੁੰਦੀ ਮੈਂ ਚਿਤਰਕਾਰੀ ਵਿੱਚ ਕੋਈ ਹਿੱਸਾ ਲਵਾਂ ਚਿੱਤਰਕਾਰੀ ਮੈਨੂੰ ਪਸੰਦ ਹੀ ਨਹੀਂ ਹੈਗੀ ਅਤੇ ਮੈਂ ਆਪਣੀ ਪੇਂਟਿੰਗ ਬਾਰੇ ਪੇਂਟਿੰਗ ਕਰਨਾ ਚਾਹੁੰਦੀ ਸੀ ਪੇਂਟਿੰਗ ਬਹੁਤ ਭਾਵੇਂ ਕੀਤੀਆਂ ਨੇ ਪਰ ਉਹ ਹੌਲੀ ਹੌਲੀ ਮੇਰਾ ਰੁਝਾਨ ਉਸ ਵੱਲ ਘੱਟ ਗਿਆ ਮੈਂ ਆਪਣੀ ਨੀਟਿੰਗ ਵਿੱਚ ਜ਼ਿਆਦਾ ਜ਼ੋਰ ਦਿੱਤਾ ਮੈਂ ਹੁਣ ਵੀ ਨੀਟਿੰਗ ਕਰਦੀ ਹਾਂ ਅਤੇ ਨਾਲੇ ਪੇਸ਼ੇ ਵਜੋਂ ਵੀ ਆਪਣੇ ਸੇਲ ਸੇਲਜ ਵੀ ਕਰਦੀ ਹਾਂ ਕੋਟੀਆਂ ਆਪਣੀਆਂ ਬਨਾ ਬਨਾ ਕੇ ਵੇਚਦੀ ਹਾਂ ਮੈਂ ਅਤੇ ਬੱਚਿਆਂ ਦੀਆਂ ਸਵੈਟਰਾਂ ਜੈਂਟਸ ਸਵੈਟਰਾਂ ਲੇਡੀ ਸਵੈਟਰਾਂ ਮੋਜੇ ਜੁਰਾਬਾਂ ਜੈਂਟਸ ਜੁਰਾਬਾਂ ਸਭ ਮੈਂ ਬੁਣ ਲੈਂਦੀ ਹਾਂ ਟੋਪੀਆਂ ਬੁਣਦੀ ਹਾਂ ਮੇਰਾ ਸਮਾਨ ਜਿਹੜਾ ਹੈ ਕੁਛ ਆਸਟ੍ਰੇਲੀਆ ਵਿੱਚ ਵੀ ਜਾ ਰਿਹਾ ਹੈ ਅਤੇ ਕੁਛ ਕਨੇਡਾ ਵਿੱਚ ਵੀ ਮੇਰਾ ਗਿਆ ਸੀ ਇੱਥੋਂ ਬਣ ਕੇ ਅਤੇ ਮੈਂ ਸਾਰੇ ਜਿਹਨਾਂ ਦਾ ਆਰਡਰ ਆ ਜਾਂਦਾ ਮੈਂ ਸਭ ਬੁਣ ਲੈਂਦੀ ਹਾਂ ਅਤੇ ਸੇਲ ਵੀ ਕਰਦੀ ਹਾਂ ਅਤੇ ਆਪਣੀਆਂ ਸਵੈਟਰਾਂ ਵੀ ਆਪ ਬੁਣ ਲੈਂਦੀ ਹਾਂ ਬੱਚਿਆਂ ਦੀਆਂ ਵੀ ਬੁਣਦੀ ਹਾਂ ਰੰਗਾਂ ਦੀ ਵੀ ਚੋਣ ਮੈਂ ਕਰ ਲੈਂਦੀ ਹਾਂ